ਮੈਨੂੰ ਯੂਟੂਬ ਤੋਂ ਦੇਖ ਕੇ ਕਰਨਾ ਬਹੁਤ ਹੀ ਵਧੀਆ ਲੱਗਦਾ ਵਾ ਯੂਟੂਬ 'ਤੇ ਜਦੋਂ ਦੱਸਦੇ ਨੇ ਅਤੇ ਉਹਦੇ ਨਾਲ ਦੇਖਣ ਦੇ ਨਾਲ ਚੀਜ਼ ਨੂੰ ਈਜ਼ੀ ਹੋ ਜਾਂਦਾ ਜੇ ਕੋਈ ਸਿਖਾਵੇ ਮੈਨੂੰ ਨਹੀਂ ਆਉਂਦਾ ਪਰ ਜੇ ਮੈਂ ਦੇਖਾਂ ਤਾਂ ਮੈਂ ਬਹੁਤ ਜਲਦੀ ਕਰ ਲੈਂਦੀ ਹਾਂ ਮੈਨੂੰ ਕਿਤਾਬਾਂ ਤੋਂ ਨਹੀਂ ਦੇਖਣਾ ਵਧੀਆ ਲੱਗਦਾ ਅਤੇ ਮੈਨੂੰ ਯੂਟੂਬ ਤੋਂ ਹਰ ਚੀਜ਼ ਉਤਾਰ ਕੇ ਬਣਾਉਣੀ ਪੜ੍ਹਨੀ ਅਤੇ ਕੋਈ ਵੀ ਸਿਲਾਈ ਦਾ ਕੋਈ ਬੁਣਤੀ ਕਰਨੀ ਆ ਜਾਂ ਕਢਾਈ ਦਾ ਕੁਛ ਕਰਨਾ ਮੈਨੂੰ ਉਹ ਬਹੁਤ ਹੀ ਸ਼ੌਂਕ ਵੀ ਆ ਵੀ ਮੈਂ ਦੇਖਾਂ ਨਵਾਂ ਨਵਾਂ ਅਤੇ ਨਵਾਂ ਨਵਾਂ ਕਰਾਂ ਅਤੇ ਫਿਰ ਮੈਨੂੰ ਉਸ ਚੀਜ਼ ਦੇ ਸ਼ੌਂਕ ਕਰਕੇ ਮੈਂ ਹਰ ਰੋਜ਼ ਕੁਛ ਨਾ ਕੁਛ ਕਰਕੇ ਦੇਖਦੀ ਰਹਿੰਦੀ ਹਾਂ ਇਸ ਲਈ ਮੈਨੂੰ ਇਹ ਇਹਨਾਂ ਗੱਲਾਂ ਲਈ ਮੈਨੂੰ ਯੂਟੂਬ ਤੋਂ ਮੈਨੂੰ ਬਹੁਤ ਵਧੀਆ ਸਾਧਨ ਲੱਗਦਾ ਵੀ ਹਰ ਲਈ ਉਹ ਇੱਕ ਚੰਗਾ ਸਾਧਨ ਆ ਹਰ ਕੋਈ ਉੱਥੋਂ ਸਾਰੇ ਵਧੀਆ ਚੀਜ਼ ਸਿੱਖ ਸਕਦੇ ਨੇ ਅਤੇ ਜੇ ਆਪਾਂ ਉੱਥੋਂ ਕੁਛ ਵੀ ਦੇਖ ਕੇ ਕੁਛ ਆਪਣਾ ਕੋਈ ਕੰਮ ਚਲਾਉਣਾ ਚਾਹੀਏ ਤਾਂ ਉਹ ਵੀ ਚੱਲ ਸਕਦਾ ਵਾ ਕਿਉਂਕਿ ਉਹ ਹਰ ਚੀਜ਼ ਸਿਖਾਉਂਦੇ ਨੇ ਆਪਾਂ ਨੂੰ ਈਜੀ ਢੰਗ ਨਾਲ ਵੀ ਸਿਖਾਈ ਜਾਂਦੀ ਆ ਆਪਾਂ ਨੂੰ ਹਰ ਚੀਜ਼ ਦੀ ਬੁਣਤੀ ਪੈਟਰਨ ਹਰ ਕੁਛ ਦੱਸਿਆ ਜਾਂਦਾ ਵੀ ਕਿਵੇਂ ਤੁਸੀਂ ਬਣਾਉਣਾ ਇਹਦਾ ਪੈਟਰਨ ਕਿੱਥੋਂ ਕੋਈ ਕਲਰ ਆਪਾਂ ਨੂੰ ਕਲਰ ਦੀ ਮੈਚਿੰਗ ਧਾਗੇ ਦੀ ਮੈਚਿੰਗ ਹਰ ਚੀਜ਼ ਦੀ ਮੈਚਿੰਗ ਮਿਲਦੀ ਆਪਾਂ ਨੂੰ ਵਧੀਆ ਅਤੇ ਬਸ ਆਪਣਾ ਮਨ ਉਹਦੇ ਵਿੱਚ ਗੱਢ ਕੇ ਇੱਕ ਵਾਰ ਤੁਸੀਂ ਦੇਖੋ ਤੁਹਾਨੂੰ ਬਹੁਤ ਈਜੀ ਲੱਗੇਗਾ ਹਰੇਕ ਚੀਜ਼ ਦਾ ਪੈਟਰਨ ਵੀ ਇੱਦਾਂ ਕਰਨਾ ਇੱਦਾਂ ਕਰਨਾ ਆਪਾਂ ਇਸ ਲਈ ਮੈਨੂੰ ਯੂਟੂਬ ਮੇਰਾ ਇੱਕ ਬਹੁਤ ਨੇੜੇ ਦਾ ਸਾਥੀ ਆ ਜਿਥੋਂ ਮੈਨੂੰ ਹਰ ਚੀਜ਼ ਦੇਖ ਕੇ ਕਰਨੀ ਮੈਨੂੰ ਬੁਣਾਈ ਦਾ ਪੈਟਰਨ ਲੈਣਾ ਕਲਰ ਦੀ ਮੈਚਿੰਗ ਲੈਣੀ ਕੱਪੜੇ ਦਾ ਦੇਖਣਾ ਵੀ ਕਿਹੜਾ ਧਾਗਾ ਯੂਜ਼ ਹੋਣਾ ਕਿਹੜੇ ਕੱਪੜੇ 'ਤੇ ਮੈਨੂੰ ਉਸ ਵਿੱਚੋਂ ਯੂਟੂਬ ਮੇਰਾ ਬਹੁਤ ਸਾਥ ਦਿੰਦਾ ਵਾ